ਵਿਆਹਾਂ ਸ਼ਾਦੀਆਂ ਦੇ ਆਨੰਦ ਮਾਣਨ ਦੇ ਤਰੀਕੇ ਬਹੁਤ ਨੇ ਜੀ ਉਰੇ ਆਪਣੇ ਤਾਂ ਪੰਜਾਬ 'ਚ ਦੇਖੋ ਸਭ ਤੋਂ ਪਹਿਲਾਂ ਤਾਂ ਖਾਣਾ ਪੀਣਾ ਠੀਕ ਹੈ ਜੀ ਮਿਠਆਈਆਂ ਹੋ ਗਈਆਂ ਤਾਂ ਖਾਣ ਪੀਣ ਦੇ ਪਹਿਲਾਂ ਸ਼ੌਕੀਨ ਹਾਂ ਕਿ ਪਹਿਲਾਂ ਜਦੋਂ ਢਿੱਡ ਭਰਦਾ ਫੇਰ ਅਸੀਂ ਜਾਂਦੇ ਹਾਂ ਕਿਤੇ ਨੱਚਣ ਨੁਚਣ ਵਾਲੇ ਪਾਸੇ ਨੂੰ ਠੀਕ ਆ ਜੀ ਮਤਲਬ ਇਹ ਹੈ ਕਿ ਵੀ ਹਾਸਾ ਮਜ਼ਾਕ ਬੋਲੀਆਂ ਪਾਉਣੀਆਂ ਗਿੱਧਾ ਜਾਗੋ ਕੱਢਣੀ ਠੀਕ ਹੈ ਵਿਆਹਾਂ 'ਤੇ ਇਹ ਸਾਰੇ ਕਾਰਜ ਜਿਹੜੇ ਹੈਗੇ ਨੇ ਉਹ ਸਾਰੇ ਆਨੰਦਮਈ ਨੇ ਅਤੇ ਸੰਗੀਤ ਜਿਹੜੇ ਗਾਣੇ ਅੱਜ ਕੱਲ੍ਹ ਚੱਲਦੇ ਨੇ ਡਾਂਸ ਕਰਨ ਨੂੰ ਜਿਹੜੇ ਵਧੀਆ ਮੰਨੇ ਜਾਂਦੇ ਨੇ ਜੀ ਉਹ ਦੇਖੋ ਸਾਰਿਆਂ ਦਾ ਟੇਸਟ ਵੱਖਰਾ ਵੱਖਰਾ ਹੈ ਅਤੇ ਜਿਹੜਾ ਸਭ ਤੋਂ ਵੱਧ ਪ੍ਰਚਲਿਤ ਆ ਉਹ ਹੈਗੇ ਨੇ ਜੀ ਸਿੱਧੂ ਮੂਸੇ ਵਾਲੇ ਦੇ ਗਾਣੇ ਉਹਦੇ 'ਚ ਇਹ ਹੈਗੇ ਨੇ ਤਾਂ ਉਹ ਆਪਣੇ ਆਪ ਨੂੰ ਇੰਸਪੀਰੇਸ਼ਨ ਵਾਲੇ ਵੀ ਕਈ ਤਾਂ ਗਾਣੇ ਹੈ ਨਾ ਸੈਲਫ ਡਿਫ ਆਪਣੀਆਂ ਆਤਮ ਉਹਦੇ ਲਈ ਹੈ ਨਾ ਪਰ ਲੋਕ ਉਹਨਾਂ ਦੇ ਉੱਤੇ ਨੱਚਦੇ ਵੀ ਬਹੁਤ ਨੇ ਅਤੇ ਵੈਸੇ ਬਾਕੀ ਜੇ ਆਪਾਂ ਉਮਰ ਦੇ ਹਿਸਾਬ ਨਾਲ ਦੇਖੀਏ ਜੀ ਪੁਰਾਣੇ ਬਜ਼ੁਰਗ ਜਿਹੜੇ ਹੈਗੇ ਨੇ ਉਹ ਪੁਰਾਣੇ ਗਾਣੇ ਲਵਾ ਕੇ ਹੀ ਖੁਸ਼ ਨੇ ਉਹਨਾਂ 'ਤੇ ਨੱਚਣਾ ਚਾਹੁੰਦੇ ਨੇ ਜਿਵੇਂ ਗੁਰਦਾਸ ਮਾਨ ਦਾ ਬਾਬੇ ਭੰਗੜਾ ਪਾਉਂਦੇ ਨੇ ਅਤੇ ਅੱਜ ਦਾ ਜਿਹੜਾ ਯੂਥ ਹੈ ਉਹ ਥੋੜ੍ਹੇ ਜਿਹੇ ਖੜਕੇ ਦੜਕੇ ਵਾਲੇ ਗਾਣਿਆਂ 'ਤੇ ਨੱਚਦਾ ਹੈ ਠੀਕ ਹੈ ਜੀ ਅਤੇ ਜਿਹੜੇ ਮੈਰੀਡ ਕਪਲਜ਼ ਨੇ ਵਿਆਹੇ ਹੋਏ ਨੇ ਵਿਆਹੇ ਹੋਇਆਂ ਨੂੰ ਥੋੜ੍ਹਾ ਜਿਹਾ ਰੋਮੈਂਟਿਕ ਜਿਹੇ ਸੋਂਗ ਵਧੀਆ ਲੱਗਦੇ ਨੇ ਉਹ ਉਹਨਾਂ 'ਤੇ ਨੱਚ ਕੇ ਖੁਸ਼ ਨੇ ਬੱਚਿਆਂ ਦਾ ਤਾਂ ਐਂ ਜੀ ਉਹਨਾਂ ਨੂੰ ਤਾਂ ਜੋ ਮਰਜ਼ੀ ਲਾ ਦਿਉ ਵੈਸੇ ਉਹਨਾਂ ਨੂੰ ਵੀ ਮੂੰਹ 'ਤੇ ਸਿੱਧੂ ਮੂਸੇ ਵਾਲਾ ਹੀ ਚੜ੍ਹਿਆ ਹੋਇਆ ਠੀਕ ਹੈ ਪਰ ਬੱਚਿਆਂ ਨੂੰ ਐਂ ਹੈ ਛੋਟਿਆਂ ਨੂੰ ਉਹ ਤਾਂ ਬਸ ਬਾ ਖਾ ਲਿਆ ਪੀ ਲਿਆ ਅਤੇ ਉਹਦਾ ਸਟੇਜ 'ਤੇ ਨੂੰ ਬਸ ਐਂ ਹੀ ਨੱਚੀ ਓ ਜਾਂਦੇ ਨੇ ਅੱਜ ਕੱਲ੍ਹ ਇਹ ਕਲਚਰ ਤਾਂ ਬਣਿਆ ਹੀ ਹੋਇਆ ਆਪਣੇ ਵਿਆਹਾਂ ਸ਼ਾਦੀਆਂ ਦੇ ਉੱਤੇ